ਖੇਤੀ ਵਿੱਚ ਸਮੇਂ ਦਾ ਮਤਲਬ ਕੁਝ ਨਹੀਂ ਹੁੰਦਾ ਖੇਤੀ ਲਗਾਤਾਰ ਸਾਰਾ ਸਾਲ ਬਾਰਾਂ ਮਹੀਨੇ ਸਾਰੇ ਬਵੰਜਾ ਹਫਤੇ ਅਤੇ ਸਾਰੇ ਹਫਤੇ ਦੇ ਘੰਟੇ ਮਿੰਟ ਚਲਦੀ ਹੀ ਰਹਿੰਦੀ ਹੈ ਇਹਦੇ ਵਿੱਚ ਕੋਈ ਪੱਕੀ ਡਿਊਟੀ ਨਹੀਂ ਹੁੰਦੀ ਕਿ ਇਸ ਸਮੇਂ ਤੁਸੀਂ ਜਾਣਾ ਇਸ ਸਮੇਂ ਆਹ ਕੰਮ ਕਰਨਾ ਉਹ ਤੁਹਾਡੀਆਂ ਲੋੜਾਂ ਮੌਸਮ ਪਾਣੀ ਜੋ ਨਹਿਰ ਦਾ ਪਾਣੀ ਇੱਕ ਸਿਸਟੇਮੈਟਿਕ ਢੰਗ ਨਾਲ ਕੈਲਕੂਲੇਟ ਕਰਕੇ ਕਿਸਾਨਾਂ ਨੂੰ ਦਿੱਤਾ ਜਾਂਦਾ ਉਹਦੀ ਵਾਰੀ ਤੁਹਾਡੀ ਕਦੋਂ ਆਉਂਦੀ ਹੈ ਉਹਦੇ ਹਿਸਾਬ ਨਾਲ ਸਾਨੂੰ ਖੇਤ ਵਿੱਚ ਜਾਣਾ ਪੈਂਦਾ ਇਹਦੇ ਲਈ ਦਿਨ ਰਾਤ ਦੁਪਹਿਰਾ ਸ਼ਾਮ ਸੁਬਹਾ ਕੋਈ ਅਰਥ ਨਹੀਂ ਰੱਖਦੇ ਬਾਕੀ ਜੋ ਉੱਥੇ ਕੀਤਾ ਜਾਂਦਾ ਉਹ ਸਾਰਾ ਤਕਰੀਬਨ ਮਿਹਨਤ ਹੁੰਦੀ ਹੈ ਅੱਜ ਕੱਲ੍ਹ ਉਹਦੇ ਲਈ ਮਸ਼ੀਨਰੀ ਆ ਗਈ ਹੈ ਹੱਥੀਂ ਮਿਹਨਤ ਕਾਫੀ ਘੱਟ ਗਈ ਹੈ ਪਰ ਫਿਰ ਵੀ ਹੱਥੀਂ ਮਿਹਨਤ ਕਾਫੀ ਹੋ ਜਾਂਦੀ ਹੱਥੀਂ ਮਿਹਨਤ ਕਰਨ ਨਾਲ ਲਗਾਤਾਰ ਬੇਸ਼ੱਕ ਧੁੱਪਾਂ ਗਰਮੀਆਂ ਵਿੱਚ ਮਸ਼ੀਨਰੀ ਵੀ ਚਲਾਉਣੀ ਹੋਵੇ ਉਹ ਵੀ ਸਾਨੂੰ ਸਰੀਰਕ ਤੌਰ 'ਤੇ ਬਲਵਾਨ ਕਰਦੀ ਹੈ ਅਤੇ ਸਾਡਾ ਉਹਦੇ ਨਾਲ ਇੱਕ ਤਰ੍ਹਾਂ ਦਾ ਵਿਰਾਸਤੀ ਸੰਬੰਧ ਜੁੜਿਆ ਹੋਇਆ ਨਾ ਕਿ ਅਸੀਂ ਕਿਸੇ ਆਮਦਨ ਨਾ ਅਸੀਂ ਕਿਸੇ ਵੱਡੇ ਲਾਹਿਆ ਖਾਤਰ ਇਹ ਖੇਤੀ ਕਰਦੇ ਹਾਂ ਸਗੋਂ ਅਸੀਂ ਇੱਕ ਵਿਰਾਸਤੀ ਕਾਰੋਬਾਰ ਵਿੱਚ ਆਪਣੇ ਪਿਤਾ ਪੁਰਖੀ ਸਮਿਆਂ ਤੋਂ ਲੈ ਕੇ ਪਏ ਹੋਏ ਹਾਂ ਅਤੇ ਇਹ ਸਾਡੇ ਸਰੀਰ ਨੂੰ ਇਸ ਤਰ੍ਹਾਂ ਜਿਵੇਂ ਕੋਈ ਯੋਗਾ ਕਰੇਗਾ ਜਾਂ ਕੋਈ ਹੋਰ ਕਿਸੇ ਕਿਸਮ ਦੀ ਖੇਡ ਕੁੱਦ ਕਰੇਗਾ ਤਾਂ ਉਹ ਸਾਰੀਆਂ ਵਰਜਿਸ਼ਾਂ ਖੇਤੀ ਦੇ ਕੰਮ ਵਿੱਚ ਆ ਜਾਂਦੀਆਂ ਅਤੇ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਖੇਤਾਂ ਵਿੱਚ ਖੁੱਲ੍ਹੀ ਹਵਾ ਦਾ ਆਨੰਦ ਮਾਨਣ ਲਈ ਖੁੱਲ੍ਹੀਆਂ ਛਾਵਾਂ ਦਾ ਆਨੰਦ ਮਾਨਣ ਲਈ ਏਸੀ ਤੋਂ ਦੂਰ ਰਹਿ ਕੇ ਇਹ ਮਹਿਸੂਸ ਕਰਨਾ ਕਿ ਅਸੀਂ ਕਿੰਨੇ ਸੌਖੇ ਹਾਂ ਇਹ ਸਿਰਫ ਖੇਤੀ ਵਿੱਚ ਹੀ ਹੋ ਸਕਦਾ